ਨਮਸਕਾਰ ਤੁਹਾਨੂੰ ਅੱਜ ਖੇਤੀ ਦੇ ਬਾਰੇ ਦੱਸਦਾ ਮੈਂ ਖੇਤੀ ਦੇ ਵਿੱਚ ਜਿਹੜੀ ਅੱਜ ਕੱਲ੍ਹ ਨਵੀਂ ਸਾਇੰਸ ਦੀਆਂ ਟੈਕਨੋਲੋਜੀਆਂ ਲੇਟੈਸਟ ਸਾਨੂੰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਕਿ ਅੱਜ ਪਹਿਲਾਂ ਤੁਸੀਂ ਦੇਖਦੇ ਹੋਵੋਗੇ ਕਿ ਪਰਿਵਾਰ ਦੇ ਸਾਰੇ ਮੈਂਬਰ ਅਗਰ ਝੋਨੇ ਦੀ ਬਿਜਾਈ ਕਰਦੇ ਸਨ ਤਾਂ ਸਾਰਾ ਪਰਿਵਾਰ ਘਰ ਦੇ ਸਾਰੇ ਜੀਅ ਖੇਤਾਂ ਵਿੱਚ ਤੁਸੀਂ ਦੇਖ ਸਕਦੇ ਸੀ ਦੁਪਹਿਰ ਦੇ ਵਿੱਚ ਉਹ ਗਰਮ ਪਾਣੀ ਦੇ ਵਿੱਚ ਖੜ੍ਹੇ ਹੋ ਕੇ ਝੋਨਾ ਕਿਸ ਤਰ੍ਹਾਂ ਬੀਜਦੇ ਸੀ ਲੇਕਿਨ ਸਾਇੰਸ ਨੇ ਇਹੋ ਜਿਹੀ ਟੈਕਨੋਲੋਜੀ ਇੱਕ ਤਿਆਰ ਕਰ ਦਿੱਤੀ ਹੈ ਮਸ਼ੀਨਾਂ ਕਈ ਇਹੋ ਜਿਹੀਆਂ ਤਿਆਰ ਕਰ ਦਿੱਤੀਆਂ ਹਨ ਜਿਹਦੇ ਨਾਲ ਉਹ ਮਸ਼ੀਨਾਂ ਇਨਸਾਨਾਂ ਦਾ ਸਾਰਾ ਕੰਮ ਆਪ ਨਿਬੇੜ ਦਿੰਦੀਆਂ ਹਨ ਅਤੇ ਇਨਸਾਨ ਵੇਖਿਆ ਜਾਵੇ ਤਾਂ ਵਿਹਲਾ ਵੀ ਹੋ ਗਿਆ ਹੈ ਅਤੇ ਇਹ ਨਵੀਆਂ ਟੈਕਨੋਲਜੀਆਂ ਜਿੱਥੇ ਸਾਡੇ ਵਾਸਤੇ ਫਾਇਦੇ ਵਾਲੀਆਂ ਵੀ ਰਹੀਆਂ ਨੇ ਅਤੇ ਉੱਥੇ ਕੁਝ ਨਾ ਕੁਝ ਨੁਕਸਾਨ ਵੀ ਇਹਨਾਂ ਦਾ ਹੈ ਕਿਉਂਕਿ ਇਨਸਾਨ ਬੇਰੁਜ਼ਗਾਰ ਹੋ ਰਿਹਾ ਜੇ ਆਪਾਂ ਡੈਅਰੀ ਦੀ ਗੱਲ ਕਰੀਏ ਤਾਂ ਪਹਿਲਾਂ ਘਰ ਦੇ ਵਿੱਚ ਦੁੱਧ ਕਰੀਮ ਮੱਖਣ ਜੋ ਹੈ ਉਹ ਆਪ ਹੀ ਲੋਕ ਹੱਥਾਂ ਨਾਲ ਕੱਢਦੇ ਸੀ ਅੱਜ ਕੱਲ੍ਹ ਮਸ਼ੀਨਾਂ ਦੇ ਵਿੱਚ ਦੁੱਧ ਪਾ ਦਿੱਤਾ ਜਾਂਦਾ ਅਤੇ ਉਹ ਇੱਕ ਪਾਸੇ ਕਰੀਮ ਨਿਕਲ ਰਹੀ ਹੈ ਇੱਕ ਪਾਸੇ ਦੁੱਧ ਨਿਕਲ ਰਿਹਾ ਇੱਕ ਪਾਸੇ ਮੱਖਣ ਦਾ ਕੋਈ ਸਿਸਟਮ ਉਹਨਾਂ ਨੇ ਮਸ਼ੀਨ ਦੇ ਵਿੱਚ ਬਣਾਇਆ ਅੱਜ ਕੱਲ੍ਹ ਟੈਕਨੋਲੋਜੀ ਬਹੁਤ ਫਾਸਟ ਹੋ ਚੁੱਕੀ ਹੈ ਸਾਇੰਸ ਦੀ ਇੰਨੀ ਤਰੱਕੀ ਜਿੱਥੇ ਫਾਇਦੇ ਵਾਲੀ ਹੈ ਉੱਥੇ ਸਾਨੂੰ ਥੋੜ੍ਹਾ ਨੁਕਸਾਨ ਵੀ ਇਹਨਾਂ ਦਾ ਝੇਲਣਾ ਪੈ ਰਿਹਾ